ਹੈਲੋ ਸਤਿ ਸ਼੍ਰੀ ਅਕਾਲ ਮੈਮ ਵਧੀਆ ਤੁਸੀਂ ਦੱਸੋ ਜੀ ਹਾਂਜੀ ਮੈਮ ਹਾਂਜੀ ਮੈਮ ਉਹ ਕਰ ਲਏ ਹੋਏ ਆ ਮੈਮ ਉਹ ਰੀਡਰ ਦਾ ਨਾ ਇੱਕ ਚੈਪਟਰ ਰੱਖਿਆ ਅਤੇ ਬਾਕੀ ਗਰਾਮਰ ਵਿੱਚੋਂ ਲੇਖ ਅਤੇ ਇੱਕ ਲਿੰਗ ਵਚਨ ਰੱਖੇ ਹੋਏ ਆ ਹਾਂਜੀ ਫਿਰ ਉਹ ਰੀਡ ਵੀ ਕਰਵਾਉਣਾ ਫਿਰ ਉਹਨਾਂ ਨੂੰ ਪ੍ਰੀਪੇਅਰ ਵੀ ਕਰਾਉਣਾ ਹੈ ਸਾਰਾ ਹਾਂਜੀ ਨਹੀਂ ਨਹੀਂ ਚੈਪਟਰ ਵੈਸੇ ਛੋਟਾ ਹੀ ਹੈ ਉਹਦੇ ਕੁਸ਼ਚਨ ਆਨਸਰ ਫਾਈਵ ਕੁਸ਼ਚਨ ਆਨਸਰ ਹੋਣਗੇ ਸ਼ਬਦਾਂ 'ਚ ਹੋਣਗੇ ਅਤੇ ਬਾਕੀ ਗਰਾਮਰ ਦਾ ਹੋਏਗਾ ਹਾਂਜੀ ਮੈਮ ਹਾਂਜੀ ਹਾਂ ਹਾਂਜੀ ਪਹਿਲਾਂ ਚੈਪਟਰ ਰੀਡ ਕਰਵਾ ਕੇ ਫਿਰ ਉਹਨਾਂ ਨੂੰ ਰਿਵਾਈਜ਼ ਕਰਵਾਵਾਂਗੇ ਉਹ ਕੁਸ਼ਚਨ ਸਭ ਫਿਰ ਗਰਾਮਰ ਦਾ ਵੀ ਕਰਵਾਉਣਾ ਲੇਖ ਹੋ ਗਿਆ ਪੱਤਰ ਹੋ ਗਿਆ ਲਿੰਗ ਵਚਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਉਹ ਲੇਖ ਜਿਹੜਾ ਹੈਗਾ ਉਹ ਪਹਿਲਾਂ ਰਿਵਾਈਜ਼ ਕੀਤਾ ਸੀ ਨਾ ਉਹਨਾਂ ਨੇ ਉਹ ਦੁਬਾਰਾ ਫਿਰ ਜੋ ਹੁਣ ਤਾਂ ਹੀ ਮੈਂ ਦੁਬਾਰਾ ਐਡ ਕੀਤਾ ਕਿ ਇੱਕ ਵਾਰ ਫਿਰ ਤੋਂ ਰਿਵੀਜ਼ਨ ਹੋ ਜਾਵੇਗੀ ਹਾਂਜੀ ਹਾਂਜੀ ਕਿਉਂਕਿ ਇਸ ਵਕਤ ਗਰਾਮਰ ਦੇ ਵਿੱਚ ਨਵਾਂ ਤਾਂ ਉਹਨਾਂ ਲਈ ਪੱਤਰ ਹੋਣਾ ਜਾਂ ਲਿੰਗ ਵਚਨ ਹੋਣਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਨਹੀਂ ਨਹੀਂ ਠੀਕ ਹੈ ਸਭ ਵਧੀਆ ਚਲਦਾ ਪਿਆ ਹੈ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਲਿੰਗ ਵਚਨ ਅਤੇ ਪੱਤਰ ਇਸੇ ਟਰਮ ਵਿੱਚ ਲਿਆ ਹੈ ਹਾਂਜੀ ਓਕੇ ਥੈਂਕ ਯੂ ਮੈਮ ਹਾਂਜੀ